ਮੇਰੀ ਮਨਪਸੰਦ ਥਾਂ ਸ਼ਿਮਲਾ ਹੈ ਕਿਉਂਕਿ ਇਹ ਦੁਨੀਆ ਦੀ ਇੱਕ ਅਜਿਹੀ ਜਗ੍ਹਾ ਜਿੱਥੇ ਮੌਸਮ ਬਹੁਤ ਠੰਡਾ ਰਹਿੰਦਾ ਹੈ ਮੈਂ ਇੱਕ ਕਿਤਾਬ ਪੜ੍ਹੀ ਸੀ ਉਸ ਵਿੱਚ ਮੈਂ ਇੱਕ ਰਾਜੇ ਦਾ ਜ਼ਿਕਰ ਸੁਣਿਆ ਸੀ ਕਿ ਉਸ ਨੇ ਕਿਸੇ ਅੰਗਰੇਜ਼ ਦੀ ਲੜਕੀ ਨੂੰ ਛੇੜ ਦਿੱਤਾ ਉਸ ਤੋਂ ਬਾਅਦ ਉਸ ਉਹਨਾਂ ਅੰਗਰੇਜ਼ਾਂ ਨੇ ਉਸ ਤੋਂ ਉਹ ਸ਼ਿਮਲਾ ਖੋਹ ਲਿਆ ਅਤੇ ਇੱਕ ਅਹਿਦ ਕੀਤਾ ਕਿ ਰਾਜਾ ਮੁੜ ਉਸ ਸ਼ਿਮਲੇ ਵੱਲ ਨਹੀਂ ਵੇਖੇਗਾ ਪਰ ਉਸ ਨੇ ਇੱਕ ਅਹਿਲਕਾਰ ਨੇ ਚਲਾਕੀ ਨਾਲ ਉਹ ਜਿਹੜਾ ਅਹਿਦਨਾਮਾ ਸੀ ਪਾੜ ਦਿੱਤਾ ਅਤੇ ਉਹ ਸ਼ਿਮਲਾ ਮੁੜ ਕੇ ਉਸ ਰਾਜੇ ਕੋਲ ਆ ਗਿਆ ਇਹ ਸ਼ਿਮਲਾ ਇਸ ਗੱਲ ਲਈ ਵੀ ਜਾਣਿਆ ਜਾਂਦਾ ਹੈ ਕਿ ਇੱਥੇ ਕਦੇ ਮੀਂਹ ਪਵੇ ਕਦੇ ਬਰਫ ਪਵੇ ਕਦੇ ਕੁਝ ਵੀ ਪਵੇ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਕਿ ਇਹ ਸਾਰਾ ਕੁਝ ਕਦੋਂ ਵਾਪਰ ਜਾਵੇਗਾ ਇਸ ਕਰਕੇ ਮੈਨੂੰ ਸ਼ਿਮਲਾ ਚੰਗਾ ਲੱਗਦਾ ਹੈ ਕਿਉਂਕਿ ਇੱਥੇ ਲਈ ਤੁਸੀਂ ਇਹ ਕਦੇ ਵੀ ਨਹੀਂ ਸੋਚ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਲੈ ਕੇ ਜਾਵੋਗੇ ਮੀਂਹ ਵਿੱਚ ਭਿੱਜਣ ਤੋਂ ਲੈ ਕੇ ਜਾਵੋਗੇ ਜਾਂ ਠੰਡ ਤੋਂ ਬਚਣ ਲਈ ਲੈ ਕੇ ਜਾਵੋਗੇ ਸੋ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਸ਼ਿਮਲਾ ਇੱਕ ਅਜਿਹੀ ਥਾਂ ਹੈ ਜਿਸ ਵਿੱਚ ਮੈਂ ਵਾਰ ਵਾਰ ਜਾਣਾ ਚਾਹਵਾਂਗਾ ਜਿੱਥੇ ਮੈਂ ਵਾਰ ਵਾਰ ਭਰੱਮਣ ਕਰਨਾ ਚਾਹਵਾਂਗਾ ਸੋ ਮੈਨੂੰ ਲੱਗਦੇ ਕਿ ਸ਼ਿਮਲਾ ਹੀ ਮੇਰੀ ਮਨਪਸੰਦ ਥਾਂ ਹੈ